ਨੌਂ ਲੱਖ ਨੜਿਨਵੇਂ ਹਜ਼ਾਰ ਨੌਂ ਸੌ ਨੱਬੇ ਨੌਂ ਲੱਖ ਨੜਿਨਵੇਂ ਹਜ਼ਾਰ ਨੌਂ ਸੌ ਅੱਸੀ ਨੌਂ ਲੱਖ ਨੜਿਨਵੇਂ ਹਜ਼ਾਰ ਨੌਂ ਸੌ ਸੱਤਰ ਨੌਂ ਲੱਖ ਨੜਿਨਵੇਂ ਹਜ਼ਾਰ ਨੌਂ ਸੌ ਸੱਠ ਨੌਂ ਲੱਖ ਨੜਿਨਵੇਂ ਹਜ਼ਾਰ ਨੌਂ ਸੌ ਪੰਜਾਹ